ਹੈਲੋ ਹਾਂਜੀ ਮੈਂ ਐਡੀਟਰ ਬੋਲ ਰਹੀ ਸੀ ਤੁਸੀਂ ਕੌਣ ਹਾਂਜੀ ਹਾਂਜੀ ਹਾਂਜੀ ਕਰਵਾ ਸਕਦੇ ਓ ਹਾਂਜੀ ਬੁੱਕ ਤੁਹਾਡੀ ਕਿੰਨੇ ਕ ਪੇਜਾਂ ਤੱਕ ਦੀ ਆ ਹਾਂਜੀ ਕੋਈ ਗੱਲ ਨੀ ਆਪਾਂ ਕਰ ਲਾਂਗੇ ਤੁਸੀਂ ਬੁੱਕ ਮਤਲਬ ਕਦੋਂ ਤੱਕ ਤੁਹਾਨੂੰ ਚਾਈਦੀ ਤੇ ਕਦੋਂ ਤੱਕ ਚਾਹੁੰਦੇ ਤੁਸੀਂ ਪਬਲਿਸ਼ ਹੋਜੇ ਹਾਂਜੀ ਜਰੂਰ ਅਸੀਂ ਕਰਾਂਗੇ ਕੋਸ਼ਿਸ਼ ਵੀ ਤੁਹਾਡੀ ਬੁੱਕ ਜਲਦੀ ਤੋਂ ਜਲਦੀ ਪਬਲਿਸ਼ ਕਰ ਦੀਏ ਕੋਸਟ ਦਸ ਹਜਾਰ ਤੱਕ ਉਹ ਕਿਉਂਕੀ ਤੁਹਾਡੇ ਪੇਜ ਜਿਆਦਾ ਬਣ ਰਹੇ ਨੇ ਨਾ ਹਾਂ ਫਿਰ ਵੀ ਜੇ ਵੀ ਘੱਟ ਤੋਂ ਘੱਟ ਵੀ ਅਸੀਂ ਅੱਠ ਹਜਾਰ ਤੱਕ ਕਰ ਸਕਦੇ ਆਂ

ਹਾਂਜੀ

ਉਹ ਨਈਂ ਨਈਂ ਇਹੋ ਜਿਹੀ ਕੋਈ ਵੀ ਦਿੱਕਤ ਨੀ ਆਏਗਾ ਆਏਗੀ ਤੁਹਾਨੂੰ ਪੂਰਾ ਵਧੀਆ ਤਰੀਕੇ ਨਾਲ ਕਰਿਆ ਹੋਇਆ ਕੰਮ ਮਿਲੇਗਾ ਹਾਂਜੀ ਅਸੀਂ ਆਪਦੇ ਵਲੋਂ ਪੂਰਾ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਨੂੰ ਕੋਈ ਵੀ ਮਤਲਬ ਕੋਈ ਵੀ ਐਹੇ ਜਿਹੀ ਗਲਤੀ ਨੀ ਹੋਏਗੀ ਹਾਂਜੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨੀ ਆਏਗੀ ਤੇ ਤੁਸੀਂ ਕਦੋਂ ਤੱਕ ਆ ਸਕਦੇ ਓ ਬੁੱਕ ਪਬਲਿਸ਼ ਕਰਵਾਣ ਦੇ ਲਈ ਹਾਂਜੀ ਕਿਉਂਕੀ ਤੁਸੀਂ ਜਿੰਨਾ ਜਲਦੀ ਤੁਸੀਂ ਕਰੋਗੇ ਫੇਰ ਉਨ੍ਹਾਂ ਈ ਘੱਟ ਟਾਈਮ ਲੱਗੇਗਾ ਪਬਲਿਸ਼ ਹੋਣ ਵਿੱਚ ਵੀ ਹਾਂਜੀ ਪਬਲਿਸ਼ ਕਰਦਾਂਗੇ ਵਧੀਆ ਤਰੀਕੇ ਨਾਲ ਡਿਸਕਾਊਂਟ ਵੀ ਵਧੀਆ ਦੇ ਰੇ ਆਂ ਅਸੀਂ ਤੁਹਾਨੂੰ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤੀ ਨਈਂ ਹੋਏਗੀ ਕੋਈ ਵੀ ਸ਼ਿਕਾਇਤ ਦਾ ਮੌਕਾ ਨੀ ਦਿੱਤਾ ਜਾਏਗਾ ਹਾਂਜੀ ਹਾਂਜੀ ਹਾਂਜੀ ਵਧੀਆ ਤਰੀਕੇ ਨਾਲ ਸਭ ਹੋਏਗਾ ਕੋਈ ਵੀ ਗਲਤੀ ਨਈਂ ਹੋਏਗੀ ਹਾਂਜੀ ਤੁਸੀਂ ਜਲਦੀ ਤੋਂ ਜਲਦੀ ਆਣ ਦੀ ਕੋਸ਼ਿਸ਼ ਕਰਿਆ ਜੇ ਹਾਂਜੀ ਠੀਕ ਐ ਓਕੇ ਜੀ